ਤੁਹਾਡੇ ਅਨੁਸਾਰ ਐਰੋਬਿਕਸ ਭੰਗੜਾ ਲੋਕੀ ਕਹਿੰਦੇ ਆ ਗਲਤ ਨੇ ਗਲਤ ਧਾਰਨਾਵਾਂ ਬਣਾਈਆਂ ਹੋਈਆਂ ਨੇ ਉਹਨਾਂ ਨੇ ਕਿਉਂਕਿ ਇਹਦੇ ਨਾਲ ਕਹਿੰਦੇ ਵਿਹਲੇ ਕੰਮ ਨੇ ਲੋਕੀ ਵਿਹਲੀਆਂ ਐਵੇਂ ਐਰੋਬਿਕਸ ਕਰਦੇ ਰਹਿੰਦੇ ਨੇ ਭੰਗੜਾ ਕਰਦੇ ਰਹਿੰਦੇ ਨੇ ਪਰ ਮਤਲਬ ਗਲਤ ਨਹੀਂ ਹੈਗਾ ਇਹਦੇ ਨਾਲ ਤੁਸੀਂ ਐਰੋਬਿਕਸ ਕਰੋਗੇ ਭੰਗੜਾ ਕਰੋਗੇ ਇਹਦੇ ਵਰਗੀ ਸਰੀਰ ਨੂੰ ਚੰਗੀ ਚੀਜ਼ ਕੋਈ ਨਹੀਂ ਹੈਗੀ ਅਗਰ ਤੁਸੀਂ ਇਹ ਕਰਦੇ ਰਹੋਗੇ ਤੇ ਤੁਹਾਡੇ ਸਰੀਰ ਦੀਆਂ ਬਿਮਾਰੀਆਂ ਵੀ ਖਤਮ ਹੋਣਗੀਆਂ ਤੇ ਨਾਲ ਸਾਰਾ ਕੁਝ ਮਤਲ ਤੁਹਾਡਾ ਠੀਕ ਹੋ ਜਾਏਗਾ ਤੇ ਤੁਸੀਂ ਦਵਾਈਆਂ ਤੋਂ ਵੀ ਛੁਟਕਾਰਾ ਪਾ ਸਕਦੇ ਇਹ ਲੋਕੀ ਬੇਫਜੂਲ ਬੋਲਦੇ ਨੇ ਕਿ ਭੰਗੜਾ ਗਲਤ ਏ ਐਰੋਬਿਕਸ ਗਲਤ ਹ ਇਹ ਗਲਤ ਗੁਲਤ ਕੁਝ ਨਹੀਂ ਹੈਗਾ ਸਭ ਕੁਝ ਠੀਕ ਹੈ ਹੈ ਕਰਦੇ ਜਾਓ ਤੇ ਆਪਣੀ ਜ਼ਿੰਦਗੀ ਚ ਤੁਸੀਂ ਤੁਹਾਡੀ ਉਮਰ ਵੀ ਲੰਬੀ ਹੋਏਗੀ ਤਾ ਆਪਣਾ ਖਾਣ ਪਾਨ ਵੀ ਲਵੇ ਧਿਆਨ ਰੱਖੋ ਬਾਹਰ ਦੀਆਂ ਚੀਜ਼ਾਂ ਖਾਂਦੇ ਰਹੋਗੇ ਤੇ ਤੁਸੀਂ ਬਿਮਾਰੀ ਆ ਜਿਆਦਾ ਲੱਗਣਗੀਆਂ ਅਗਰ ਤੁਸੀਂ ਘਰ ਦੀਆਂ ਚੀਜ਼ਾਂ ਐਰੋਬੀਸ ਕਰੋਗੇ ਭੰਗੜਾ ਕਰੋਗੇ ਜਾਂ ਸੈਰ ਸੁਰ ਕਰੋਗੇ ਤੇ ਬਹੁਤ ਵਧੀਆ ਤੁਹਾਡੀ ਜਿੰਦਗੀ ਹੋਏਗੀ ਇਹ ਆਪਣੇ ਬੱਚਿਆਂ ਨੂੰ ਵੀ ਸ਼ਿਕਸ਼ਾ ਦਿਓ ਤੇ ਨਾਲੇ ਬਜ਼ੁਰਗਾਂ ਨੂੰ ਵੀ ਦਿਓ ਤੇ ਜਵਾਨਾਂ ਨੂੰ ਵੀ ਦਿਓ ਅਗਰ ਸਾਰੇ ਇਹੀ ਰਾਹ ਤੇ ਚੱਲ ਗਏ ਤੇ ਆਉਣ ਵਾਲੇ ਟਾਈਮ 'ਚ ਇੰਡੀਆ ਦੇ ਵਿੱਚੋਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਸਾਰੇ ਖੁਸ਼ ਤਬੀਅਤ ਰਹਿਣਗੇ ਤੇ ਬੱਚੇ ਵੀ ਖੁਸ਼ ਰਹਿਣਗੇ ਤੇ ਉਹਨਾਂ ਦਾ ਪੜਾਈ ਚ ਵੀ ਮੰਨ ਲੱਗੇਗਾ ਦਿਮਾਗ ਵੀ ਠੀਕ ਰਹੇਗਾ ਧੰਨਵਾਦ